ਮੇਰੇ ਖਿਆਲ ਨਾਲ ਗੇਮਿੰਗ ਦੇ ਵਿੱਚ ਭਵਿੱਖ ਬਹੁਤ ਹੀ ਵਧੀਆ ਲੱਗਦਾ ਹੈ ਜਿਵੇਂ ਕਿ ਸਾਡੇ ਅੱਜ ਕੱਲ੍ਹ ਦੇ ਯੂਟਿਊਬਰਸ ਵਗੈਰਾ ਵੀ ਗੇਮਿੰਗ ਕਰ ਕਰਕੇ ਉਹਦੀ ਲਾਈਫ ਸਟਰੀਮਿੰਗ ਯੂਟਿਊਬ ਵਗੈਰਾ 'ਤੇ ਅਪਲੋਡ ਕਰਦੇ ਹਨ ਜਿਨ੍ਹਾਂ ਨੂੰ ਲੋਕ ਵਗੈਰਾ ਬਹੁਤ ਪਸੰਦ ਕਰਦੇ ਹਨ ਅਤੇ ਉਹਨਾਂ ਤੋਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਖੁਦ ਵੀ ਗੇਮਿੰਗ ਕਰਦੇ ਹਨ ਅਤੇ ਗੇਮਿੰਗ ਯੂਟਿਊਬ 'ਤੇ ਕਰ ਕਰਕੇ ਵੀਡੀਓ ਦੀਆਂ ਵਿਊਜ ਵਗੈਰਾ ਲੈਣ ਕਾਫੀ ਲੈਂਦੇ ਹਨ ਅਤੇ ਉਹਨਾਂ ਦੁਆਰਾ ਉਹਨਾਂ ਨੂੰ ਪੈਸਾ ਆਉਂਦਾ ਹੈ ਅਤੇ ਅਗਰ ਇੰਟਰਨੈਸ਼ਨਲ ਲੈਵਲ 'ਤੇ ਗੱਲ ਕਰੀਏ ਤਾਂ ਰਾਈਟ ਗੇਮਸ ਇੱਕ ਕੰਪਨੀ ਹੈ ਜੋ ਕਿ ਹਰ ਸਾਲ ਬਾਅਦ ਇੱਕ ਵੀ ਸੀ ਟੀ ਨਾਂ ਦਾ ਇੱਕ ਕੰਪਟੀਸ਼ਨ ਵੀ ਕਰਵਾਉਂਦੀ ਆ ਜਿਹਦੇ ਵਿੱਚ ਕਿ ਜਿੱਤਣ ਵਾਲੇ ਨੂੰ ਬਾਰਾਂ ਕਰੋੜ ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ ਵੀ ਸੀ ਟੀ ਕੰਪਨੀ ਵੱਲੋਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੇਮਾਂ ਜਿਸ ਤਰ੍ਹਾਂ ਕਿ ਸਾਡੀ ਪਬਜੀ ਗੇਮ ਹੈਗੀ ਆ ਕਰਾਫਟ ਮੋਬਾਈਲ ਲਿੰਕ ਇਹਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਲੈਵਲਸ ਹੁੰਦੇ ਨੇ ਜਿਨ੍ਹਾਂ ਨੂੰ ਪਾਰ ਕਰਨ 'ਤੇ ਕਾਫੀ ਤਰ੍ਹਾਂ ਦੀਆਂ ਓਪਰਚੁਨਟੀਆਂ ਮਿਲਦੀਆਂ ਨੇ ਅਤੇ ਹੋਰ ਵੀ ਇੱਦਾਂ ਦੀਆਂ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਗੇਮਸ ਹੈਗੀਆਂ ਵਾ ਉਹ ਸਾਡੇ ਇੱਥੇ ਇੰਟਰਨੈੱਟ 'ਤੇ ਅਵੇਲੇਬਲ ਨੇ ਜਿਨ੍ਹਾਂ ਨੂੰ ਖੇਡ ਕੇ ਤੁਸੀਂ ਕਾਫੀ ਤਰ੍ਹਾਂ ਦੇ ਪੈਸੇ ਵੀ ਕਮਾ ਸਕਦੇ ਹੋ ਅਤੇ ਆਪਣਾ ਅਰਨ ਕਰ ਸਕਦੇ